ਵੈਸੇ ਅਸੀਂ ਸਾਰਿਆਂ ਨੇ ਕਦੀ ਨਾ ਕਦੀ ਚਿੱਤਰਕਾਰੀ ਦੀਆਂ ਵਰਕਸ਼ੋਪ ਦੀ ਕਲਾਸ ਲਗਾਈ ਹੋਏਗੀ ਵੈਸੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਚਿੱਤਰਕਾਰੀ ਦੀ ਕਲਾਸ 'ਚ ਕੀ ਹੁੰਦਾ ਹੈ ਅਤੇ ਵਰਕਸ਼ਾਪ ਦੀ ਕਲਾਸ 'ਚ ਕੀ ਹੁੰਦਾ ਹੈ ਜੇ ਕਿਸੇ ਨੂੰ ਵਰਕਸ਼ੋਪ ਦੀ ਕਲਾਸ ਬਾਰੇ ਨਹੀਂ ਪਤਾ ਤਾਂ ਪਰ ਉਹਨੂੰ ਚਿੱਤਰਕਾਰੀ ਦੀ ਕਲਾਸ ਬਾਰੇ ਜ਼ਰੂਰ ਪਤਾ ਹੋਏਗਾ ਕਿਉਂਕਿ ਅਸੀਂ ਸਾਰਿਆਂ ਨੇ ਕਦੀ ਨਾ ਕਦੀ ਚਿੱਤਰਕਾਰੀ ਦੀ ਕਲਾਸ ਆਪਣੇ ਸਕੂਲ ਦੇ ਟਾਈਮ 'ਚ ਜ਼ਰੂਰ ਲਗਾਈ ਹੋਏਗੀ ਜਦੋਂ ਕਿ ਅਸੀਂ ਇਹ ਜਾਣਦੇ ਹਾਂ ਕਿ ਚਿੱਤਰਕਾਰੀ ਕਾਫੀ ਜ਼ਿਆਦਾ ਮੁਸ਼ਕਿਲ ਵੀ ਹੋ ਜਾਂਦੀ ਹੈ ਅਤੇ ਕਈ ਵਾਰੀ ਕਾਫੀ ਜ਼ਿਆਦਾ ਆਸਾਨ ਹੋ ਜਾਂਦੀ ਹੈ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਆਪਣੀ ਚਿੱਤਰਕਾਰੀ ਕਰਦੇ ਪਏ ਹੋ ਜੇ ਤੁਸੀਂ ਕਾਫੀ ਜ਼ਿਆਦਾ ਆਰਾਮ ਦੇ ਨਾਲ ਕਰਦੇ ਪਏ ਹੋ ਇਸ ਦਾ ਮਤਲਬ ਤੁਹਾਡੀ ਚਿੱਤਰਕਾਰੀ ਕਾਫੀ ਜ਼ਿਆਦਾ ਵਧੀਆ ਬਣੇਗੀ ਯਾਨੀ ਕਿ ਜੇ ਜੋ ਤੁਸੀਂ ਤਸਵੀਰ ਬਣਾ ਰਹੇ ਹੋ ਉਹ ਕਾਫੀ ਜ਼ਿਆਦਾ ਸਾਫ਼ ਬਣੇਗੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਚਿੱਤਰਕਾਰੀ ਦੇ ਵਿੱਚ ਕਾਫੀ ਜ਼ਿਆਦਾ ਜਲਦਬਾਜ਼ੀ ਕਰਨੀ ਹੈ ਜਾਂ ਬਹੁਤ ਜ਼ਿਆਦਾ ਟਾਈਮ ਲਾਉਣਾ ਹੈ ਤੁਸੀਂ ਉਨਾਂ ਹੀ ਟਾਈਮ ਲਾਓ ਜਿੰਨਾ ਕਿ ਤੁਹਾਡੇ ਲਈ ਜਾਇਜ਼ ਹੈ ਕਿਉਂਕਿ ਚਿੱਤਰਕਾਰੀ ਦੇ ਵਿੱਚ ਕਾਫੀ ਜ਼ਿਆਦਾ ਟਾਈਮ ਲੱਗਦਾ ਹੈ ਇਹ ਫੋਟੋ 'ਤੇ ਵੀ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਫੋਟੋ ਵੱਲ ਵੇਖ ਕੇ ਜਾਂ ਕਿਸ ਤਸਵੀਰ ਵੱਲ ਵੇਖ ਕੇ ਤੁਸੀਂ ਉਹ ਚਿੱਤਰਕਾਰੀ ਕਰਦੇ ਪਏ ਹੋ ਜੇ ਕਿਸੇ ਨੇ ਚਿੱਤਰਕਾਰੀ ਦੀ ਕਲਾਸ ਲਗਾਈ ਹੈ ਅਤੇ ਨਾਲ ਨਾਲ ਇਹ ਵੀ ਦੱਸਦਾ ਕਿ ਵਰਕਸ਼ੋਪ ਦੀ ਕਲਾਸ ਵੀ ਇੱਕ ਇਹਦਾ ਹੀ ਇੱਕ ਹਿੱਸਾ ਹੈ ਜਾਂ ਕਹਿ ਸਕਦੇ ਹੋ ਕਿ ਵਰਕਸ਼ੋਪ ਵੀ ਚਿੱਤਰਕਾਰੀ ਤੋਂ ਵਗੈਰ ਅਧੂਰੀ ਹੈ ਕਿਉਂਕਿ ਚੀ ਕਿਉਂਕਿ ਤੁਸੀਂ ਜਦੋਂ ਵਰਕਸ਼ੋਪ ਲਗਾ ਰਹੇ ਹੁੰਦੇ ਹੋ ਤੁਸੀਂ ਇਹ ਦੇਖਦੇ ਹੋ ਕਿ ਕਿਸੇ ਵੀ ਚੀਜ਼ ਦਾ ਆਕਾਰ ਕਿੱਦਾਂ ਦਾ ਹੈ ਕਿੱਦਾਂ ਦਾ ਉਹਨੂੰ ਅਸੀਂ ਡਿਜ਼ਾਇਨ ਦੇ ਸਕਦੇ ਹਾਂ ਕਿੰਨਾ ਕੁ ਉਹਦੀ ਮੇਜਰਮੈਂਟ ਕਰ ਸਕਦੇ ਹਾਂ ਕਿੰਨਾ ਕੁ ਉਹ ਵੱਡਾ ਹੈ ਜਾਂ ਛੋਟਾ ਹੈ ਇਹ ਸਾਰੀਆਂ ਚੀਜ਼ਾਂ ਸਾਨੂੰ ਮ ਚਿੱਤਰਕਾਰੀ ਤੋਂ ਹੀ ਪਤਾ ਲੱਗਦੀਆਂ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਵਰਕਸ਼ੋਪ ਦੇ ਨਾਲ ਨਾਲ ਚਿੱਤਰਕਾਰੀ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਜੇ ਕਿਸੇ ਨੇ ਚਿੱਤਰਕਾਰੀ ਵੀ ਦੇ ਵਿੱਚ ਮਹਾਰਥ ਹਾਸਲ ਕੀਤੀ ਹੈ ਤਾਂ ਉਹਦੇ ਲਈ ਵਰਕਸ਼ੋਪ ਲਗਾਉਣਾ ਕੋਈ ਇੰਨੀ ਵੀ ਜ਼ਿਆਦਾ ਮੁਸ਼ਕਿਲ ਗੱਲ ਨਹੀਂ ਬਸ ਤੁਹਾਨੂੰ ਸਹੀ ਤਰੀਕੇ ਨਾਲ ਉਸ ਚੀਜ਼ ਨੂੰ ਆਕਾਰ ਦੇਣਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਆਪਣੀ ਚਿੱਤਰਕਾਰੀ ਦੇ ਵਿੱਚ ਆਪਣਾ ਜ਼ਿਆਦਾ ਖਿਆਲ ਰੱਖਣਾ ਹੈ ਧੰਨਵਾਦ